ਨਮਸ਼ਕਾਰ ਜੀ ਮੇਰਾ ਨਾਮ ਸ਼ਸ਼ੀ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਅਤੇ ਮੈਂ ਇੱਕ ਹਾਊਸਵਾਈਫ ਹਾਂ ਅਤੇ ਅੱਜ ਕੱਲ੍ਹ ਦੇ ਤੁਹਾਨੂੰ ਇਹ ਜਾਣਦੇ ਵੀ ਸਮੇਂ ਦੇ ਵਿੱਚ ਔਰਤ ਨੂੰ ਆਪਣੇ ਲਈ ਆਪਣੇ ਸਰੀਰ ਦਾ ਧਿਆਨ ਰੱਖਣ ਲਈ ਕੋਈ ਟਾਈਮ ਨਹੀਂ ਲ ਹੁੰਦਾ ਪਰ ਫਿਰ ਵੀ ਸਾਨੂੰ ਆਪਣੇ ਰੁਝਾਨ ਦੇ ਵਿੱਚੋਂ ਥੋੜ੍ਹਾ ਜਿਹਾ ਟਾਈਮ ਸਾਨੂੰ ਆਪਣੇ ਸਰੀਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਕਿ ਅੱਜ ਕੱਲ੍ਹ ਹਰ ਜਗ੍ਹਾ 'ਤੇ ਜੋ ਲਾਏ ਜਾਂਦੇ ਹਨ ਕਈ ਸਕੂਲਾਂ 'ਚ ਲੱਗਦੇ ਆ ਕੋਈ ਸਵੇਰੇ ਲਗਾਉਂਦਾ ਕੋਈ ਦੁਪਹਿਰ ਨੂੰ ਲਗਾਉਂਦਾ ਅਤੇ ਜਦੋਂ ਅਸੀਂ ਮਤਲਬ ਮੰਨ ਲਓ ਵੀ ਅਸੀਂ ਤੋਂ ਬਾਅਦ ਅਸੀਂ ਥੋੜ੍ਹਾ ਆਪਣਾ ਟਾਈਮ ਆਪਣੇ ਵਾਸਤੇ ਕੱਢ ਸਕਦੇ ਹਾਂ ਅਤੇ ਸਾਨੂੰ ਵੀ ਆਪਣੇ ਯੋਗ ਕਰਨਾ ਬਹੁਤ ਜ਼ਰੂਰੀ ਹੈ ਜਿਹਦੇ ਵਿੱਚ ਵੀ ਆਪਣੇ ਆਪਣੇ ਸਰੀਰ ਦੀ ਤੰਦਰੁਸਤੀ ਵਾਸਤੇ ਸਾਨੂੰ ਆਪਣਾ ਜੋ ਆਸਣ ਜ਼ਰੂਰ ਕਰਨਾ ਚਾਹੀਦਾ ਅਤੇ ਜਿਹਦੇ ਵਿੱਚ ਯੂ ਅਭਿਆਸ ਜਿਹਨੂੰ ਜਾਂਦਾ ਵੀ ਜਿਹਦੇ ਵਿੱਚ ਅਸੀਂ ਆਪ ਆਪਣੀ ਆਤਮਾ ਨੂੰ ਸ਼ਾਂਤ ਵਾਸਤੇ ਸਾਨੂੰ ਆ ਆਪਣਾ ਧਿਆਨ ਲਗਾਉਣ ਵਾਲੀ ਨੂੰ ਯੋਗ ਕਰਨਾ ਚਾਹੀਦਾ ਹੈ ਜਿਹਦੇ ਵਿੱਚ ਸਾਨੂੰ ਆਪਣੀ ਆਤਮਾ ਦੀ ਸ਼ਾਂਤੀ ਵੀ ਮਿਲਦੀ ਹੈ ਅਤੇ ਅਤੇ ਸਰੀਰ ਦੀ ਠੀਕ ਰਹਿੰਦਾ ਆ ਜਿਵੇਂ ਅਸੀਂ ਆਪਣਾ ਯੋਗ ਵਿੱਚ ਦੱਸਦੇ ਹਨ ਵੀ ਇੱਕ ਆਸਣ ਦੇ ਰੂਪ ਦੇ ਵਿੱਚ ਬੈਠੋ ਤੇ ਅਤੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਸੋਹਣੇ ਤਰੀਕੇ ਦੇ ਨਾਲ ਸ਼ਾਂਤ ਹੋ ਕੇ ਇਕਾਂਤ ਦੇ ਵਿੱਚ ਬਹਿ ਕੇ ਅਸੀਂ ਆਪਣਾ ਧਿਆਨ ਜੋ ਕਰ ਸਕਦੇ ਹਾਂ ਧਿਆਨ ਦੇ ਨਾਲ ਹੈ ਵੀ ਥੋੜ੍ਹੀ ਦੇਰ ਸਾਡੇ ਆਪਣੇ ਦਿਲ ਦੀ ਜਾਨੀ ਧੜਕਣ ਹੈ ਉਹਨੂੰ ਵੀ ਰੈਸਟ ਮਿਲਦੀ ਹੈ ਅਤੇ ਸਾਡਾ ਧਿਆਨ ਪਰਮਾਤਮਾ ਨਾਲ ਜੁੜਦਾ ਆ ਇਕ ਮੰਥ ਦੇ ਵਿੱਚ ਹੀ ਯੋਗ ਲਗਾਇਆ ਜਾਂਦਾ ਆ ਅਤੇ ਉਹਦੇ ਨਾਲ ਸਾਨੂੰ ਥੋੜ੍ਹੀ ਦੇਰ ਲਈ ਆਪਣੇ ਮਨ ਨੂੰ ਸ਼ਾਂਤ ਰੱਖਣਾ ਪੈਂਦਾ ਅਤੇ ਉਹਦੇ ਨਾਲ ਹੀ ਸਾਡੇ ਸਰੀਰ ਦਿਲ ਅਤੇ ਦਿਮਾਗ ਦੋਨੋਂ ਤੰਦਰੁਸਤ ਰਹਿੰਦੇ ਨੇ ਅਤੇ ਇਹਦੇ ਨਾਲ ਸਾਨੂੰ ਰੋਜ਼ ਘੱਟੋ ਘੱਟ ਆਪਣਾ ਇਹ ਆਸਣ ਜ਼ਰੂਰ ਕਰਨਾ ਚਾਹੀਦਾ ਜਿਹਦੇ ਨਾਲ ਸਾਡਾ ਮਨ ਵੀ ਸ਼ਾਂਤ ਰਹਿੰਦਾ ਆ ਅਤੇ ਆਪਣਾ ਸਰੀਰ ਵੀ ਤੰਦਰੁਸਤ ਰਹਿੰਦਾ ਆ ਅਤੇ ਯੋਗਾ ਵੈਸੇ ਹੀ ਬਹੁਤ ਅੱਛਾ ਯੋਗ ਹੈ ਵੀ ਜਿਹਦੇ ਨਾਲ ਸਾਨੂੰ ਹਰ ਤਰ੍ਹਾਂ ਦੇ ਸਰੀਰ ਦੀਆਂ ਬਿਮਾਰੀਆਂ ਤੋਂ ਨਿਜਾਤ ਮਿਲਦੀ ਹੈ ਅਤੇ ਸਾਨੂੰ ਆਪਣੇ ਲਈ ਜਿੱਥੇ ਕੰਮਾਂ ਕਾਰਾਂ ਦੇ ਵਿੱਚੋਂ ਜ਼ਰੂਰ ਟਾਈਮ ਕੱਢ ਕੇ ਆਪਣੇ ਲਈ ਵੀ ਥੋੜ੍ਹਾ ਟਾਈਮ ਯੋਗਾ ਵਾਸਤੇ ਕੱਢਣਾ ਚਾਹੀਦਾ ਜਿੰਨਾਂ ਸਾਡਾ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਠੀਕ ਕਰ ਸਕਦਾ ਅਤੇ ਫਿਰ ਅਸੀਂ ਵੀ ਆਪਣਾ ਟਾਈਮ ਯੋਗਾ ਵਾਸਤੇ ਜ਼ਰੂਰ ਕੱਢਾਂਗੇ ਅਤੇ ਆਪਣੇ ਸਰੀਰ ਨੂੰ ਨਿਰੋਇਆ ਰੱਖਾਂਗੇ ਧੰਨਵਾਦ